ਉੱਨੀ ਸੌ ਸਤਾਰਾਂ ਵਿੱਚ ਟਕਨੋਲਜੀ ਦਾ ਇੱਕ ਬੂਮ ਹੋਇਆ ਸੀ ਸੰਨ ਦੋ ਹਜ਼ਾਰ ਵਿੱਚ ਨਵੀਆਂ ਨਵੀਆਂ ਨੌਕਰੀਆਂ ਨਿਕਲਣਾ ਸ਼ੁਰੂ ਹੋਈਆਂ ਜਿਹੜੀਆਂ ਕੁਝ ਸਾਲਾਂ ਪਹਿਲੇ ਤੱਕ ਐਗਸਿਸਟ ਵੀ ਨਹੀਂ ਕਰਦੀਆਂ ਸਨ ਟੈਕਨੋਲਜੀ ਨੇ ਨਵੀਆਂ ਨੌਕਰੀਆਂ ਨੂੰ ਜਨਮ ਦਿੱਤਾ ਆ ਜਿਵੇਂ ਐਪ ਡਿਵੈਲਪਰ ਸੋਫਟਵੇਅਰ ਇੰਜੀਨੀਅਰ ਵੀਡੀਓ ਐਡੀਟਰ ਜਾਂ ਫਿਰ ਐਥੀਕਲ ਹੈਕਰ ਵਗੈਰਾ ਵਗੈਰਾ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲੋਜੀ ਅੱਗੇ ਵੱਧ ਰਹੀ ਹੈ ਉਸੇ ਤਰ੍ਹਾਂ ਨਵੀਆਂ ਨਵੀਆਂ ਨੌਕਰੀਆਂ ਵੀ ਨਿਕਲ ਕਰ ਆ ਰਹੀਆਂ ਨੇ ਜਿੱਦਾਂ ਹੁਣ ਏ ਆਈ ਦਾ ਬਹੁਤ ਜ਼ਿਆਦਾ ਸਕੋਪ ਵੱਧ ਰਿਹਾ ਹੈ ਉਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਉਣ ਵਾਲੇ ਭਵਿੱਖ 'ਚ ਨਵੀਆਂ ਨੌਕਰੀਆਂ ਇਸ ਤੋਂ ਰਿਲੇਟਡ ਹੀ ਆਉਣਗੀਆ ਟੈਕਨੋਲਜੀ ਸਾਨੂੰ ਇਕੱਠੇ ਕਰਕੇ ਰੱਖਦੀ ਹੈ ਅਤੇ ਨੌਕਰੀਆਂ ਵੀ ਪ੍ਰਦਾਨ ਕਰਦੀ ਹੈ ਦੇਖਿਆ ਜਾਵੇ ਤਾਂ ਜਿੰਨੀਆਂ ਵੀ ਨੌਕਰੀਆਂ ਅੱਜ ਦੇ ਸਮਾਜ ਵਿੱਚ ਹੈਗੀਆਂ ਨੇ ਉਹਨਾਂ ਵਿੱਚੋਂ ਨੱਬੇ ਪ੍ਰਤੀ ਨੱਬੇ ਪ੍ਰਤੀਸ਼ਤ ਨੌਕਰੀਆਂ ਟੈਕਨੋਲਜੀ ਕਰਕੇ ਹੀ ਜਿੰਦਾ ਹਨ ਜਿੱਦਾਂ ਕਾਰ ਡਰਾਈਵਰ ਦੀ ਨੌਕਰੀ ਉਹਨੂੰ ਉਹਦੇ ਹੀ ਪੋਸੀਬਲ ਸੀਗੀ ਜਦੋਂ ਕੋਈ ਕਾਰ ਬਣ ਗਈ ਜੇ ਕੋਈ ਕਾਰ ਨਾ ਬਣਦੀ ਤਾਂ ਅੱਜ ਵੀ ਲੋਕ ਘੋੜਾ ਗਾਡੀ ਚਲਾ ਰਹੇ ਹੁੰਦੇ ਠੀਕ ਹੈ ਜੀ ਪਰ ਹਰ ਕੋਈ ਘੋੜਾ ਗਾਡੀ ਚਲਾਉਣਾ ਨਹੀਂ ਸਿੱਖ ਸਕਦਾ ਸਿੱਖ ਸਕਦਾ ਪਰ ਕਾਰ ਚਲਾਉਣ ਤੋਂ ਕਾਫੀ ਅਲੱਗ ਹੁੰਦਾ ਵਾ ਅਤੇ ਟੈਕਨੋਲੋਜੀ ਨੇ ਨਵੀਆਂ ਨਵੀਆਂ ਔਰ ਵੀ ਨੌਕਰੀਆਂ ਕੱਢੀਆਂ ਜਿਵੇਂ ਐਸ਼ੋਨੋਟ ਸਾਇੰਟਿਸਟ ਵਗੈਰਾ ਸਾਇੰਟਿਸਟ ਹੀ ਟੈਕਨੋਲੋਜੀ ਨੂੰ ਬਣਾਉਂਦਾ ਹੈ ਪਰ ਸਾਇੰਟਿਸਟ ਹੀ ਟੈਕਨੋਲੋਜੀ ਕਰ ਕੇ ਆਪਣੀ ਨੌਕਰੀ ਵੀ ਪਾਉਂਦਾ ਹੈ